ਨੰਬਰ ਇੱਕ ਅਠਾਈ ਮਾਰਚ ਉੱਨੀ ਸੌ ਸਤਾਸੀ ਨੰਬਰ ਦੋ ਇੱਕ ਮਈ ਉੱਨੀ ਸੌ ਉਨਾਨਵੇਂ ਨੰਬਰ ਤਿੰਨ ਵੀਹ ਅਪ੍ਰੈਲ ਉੱਨੀ ਸੌ ਨੱਬੇ ਨੰਬਰ ਚਾਰ ਇਕੱਤੀ ਨਵੰਬਰ ਦੋ ਹਜ਼ਾਰ ਤੇਰਾਂ ਨੰਬਰ ਪੰਜ ਸਤਾਈ ਮਾਰਚ ਦੋ ਹਜ਼ਾਰ ਇੱਕੀ